ਮੈਂ ਹਮੇਸ਼ਾਂ ਆਪਣੇ ਕਿਰਦਾਰਾਂ ਦਾ ਵਿਕਾਸ ਸੱਚਾ ਹੀ ਕਰਦੀ ਹਾਂ ਕਿਉਂਕਿ ਮੇਰੀਆਂ ਜਿਹੜੀਆਂ ਕਹਾਣੀਆਂ ਨੇ ਸਾਰੀਆਂ ਹੀ ਰੋਜ਼ਾਨਾ ਜ਼ਿੰਦਗੀ 'ਤੇ ਨੇ ਕੋਈ ਵੀ ਕਿਰਦਾਰ ਮੇਰਾ ਅਪਮਾਨ ਨਾ ਗੱਲਾਂ ਜੀ ਕੋਈ ਨਹੀਂ ਲਿਖਿਆ ਜਾਂਦੀਆਂ ਜੋ ਅਸਲ ਜ਼ਿੰਦਗੀ ਵਿੱਚ ਵਾਪਰਦਾ ਹੈ ਉਹ ਹੀ ਕਹਾਣੀਆਂ ਵਿੱਚ ਛਾਪਿਆ ਜਾਂਦਾ ਹੈ ਜਾਂ ਲਿਖਿਆ ਜਾਂਦਾ ਹੈ ਮੇਰੀਆਂ ਮੇਰੀਆਂ ਜਿਹੜੀਆਂ ਰਚਨਾਵਾਂ ਨੇ ਉਹ ਸਾਰੀਆਂ ਹੀ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਨੇ ਅਤੇ ਕਿਰਦਾਰ ਸਾਰੇ ਸੱਚੇ ਅਤੇ ਸੁੱਚੇ ਨੇ ਕਿਸੇ ਵੀ ਕਿਰਦਾਰ ਦੇ ਨਾਲ ਕੋਈ ਵੀ ਮਤਲਬ ਬਦਸਲੂਕੀ ਜਾਂ ਹੇਰਾਫੇਰੀ ਕਰਕੇ ਕੋਈ ਵੀ ਕਿਰਦਾਰ ਦੇ ਨਾਲ ਉਹਨਾਂ ਦਾ ਅਪਮਾਨ ਨਹੀਂ ਕੀਤਾ ਜਾਂਦਾ ਇਸ ਲਈ ਮੇਰੀਆਂ ਕਹਾਣੀਆਂ ਦੇ ਵਿੱਚ ਕੋਈ ਵੀ ਕਿਰਦਾਰ ਝੂਠੇ ਅਤੇ ਅਪਮਾਨਜਨਕ ਗੱਲਾਂ ਨਹੀਂ ਲਿਖੀਆਂ ਜਾਂਦੀਆਂ ਇਹ ਗੱਲਾਂ ਸਾਰੀਆਂ ਹੀ ਰੋਜ਼ਾਨਾ ਜਿੰਦਗੀ ਅਤੇ ਅਸਲ ਘਟਨਾਵਾਂ ਦੇ ਨਾਲ ਸੰਬੰਧਿਤ ਹਨ ਸਾਰੇ ਕਿਰਦਾਰ ਸੱਚੇ ਨੇ ਕੋਈ ਵੀ ਕਿਰਦਾਰ ਝੂਠਾ ਨਹੀਂ ਹੈ